ਬਰਨਾਲਾ ਖਾਨ ਮੀਟ ਸ਼ਾਪ ਤੋਂ ਬੋਲ ਰਹੇ ਹੋ ਜੀ ਅਸੀਂ ਜੀ ਮੀਟ ਚਾਹੀਦਾ ਜੀ ਸਾਨੂੰ ਸਾਡੇ ਵਿਆਹ ਸੀ ਜੀ ਹਾਂਜੀ ਤੁਹਾਡਾ ਐਡਰੈਸ ਜੀ

ਅੱਛਾ ਜੀ ਫਿਸ਼ ਵਗੈਰਾ ਜੀ ਫਿਸ਼ ਵਗੈਰਾ ਵਧੀਆ ਮਿਲ ਜਾਊਗੀ ਜੀ ਮੁਰਗਾ ਮੁਰਗਾ ਬੱਕਰਾ ਜੀ ਹਾਂਜੀ ਅੱਛਾ ਜੀ ਸਾਡੇ ਵੀ ਗੁਆਢ 'ਚ ਵਿਆਹ ਸੀ ਜੀ ਉਹਨਾਂ ਨੇ ਚੱਕਿਆ ਸੀ ਤੁਹਾਡੇ ਤੋਂ ਮੀਟ ਸਾਨੂੰ ਵੀ ਉਹਨਾਂ ਨੇ ਦੱਸਿਆ ਸੀ ਕਿ ਇਹਨਾਂ ਦਾ ਮੀਟ ਬਹੁਤ ਵਧੀਆ ਹੈ ਜੀ ਹਾਂਜੀ ਹਾਂਜੀ ਉਹ ਤਾਂ ਦੇਖਿਆ ਸੀ ਵਿਆਹ ਵਿੱਚ ਤੁਹਾਡਾ ਮੀਟ ਬਹੁਤ ਸਾਫ ਸਫਾਈ ਵਾਲਾ ਅਤੇ ਪਸੰਦ ਆ ਗਿਆ ਵਧੀਆ ਸੀ ਜੀ ਹਾਂਜੀ ਹਾਂਜੀ ਹਾਂਜੀ ਮੈਂ ਜੀ ਸਿੰਮੀ ਪੇਲਸ ਨੀਅਰ ਹੰਡਿਆਇਆ ਰੋੜ ਜੀ ਉੱਥੇ ਚਾਹੀਦਾ ਜੀ ਹੈਂ ਜੀ ਤੀਹ ਸਿਤੰਬਰ ਨੂੰ ਜੀ ਤੀਹ ਸਤੰਬਰ ਨੂੰ ਜੀ ਹਾਂਜੀ ਕੀ ਰੇਟ ਰੂਟ ਕੀ ਰੇਟ ਰੂਟ ਲਾਓਗੇ ਜੀ ਹਾਂਜੀ

ਅੱਛਾ ਜੀ ਹਾਂਜੀ ਹਾਂਜੀ ਹਾਂਜੀ ਸਾਨੂੰ ਜੀ ਤੀਹ ਪੈਂਤੀ ਕਿਲੋ ਚਾਹੀਦਾ ਜੀ ਬਸ ਜੀ ਮੁਰਗਾ ਮੁਰਗਾ ਜੀ ਬੱਕਰਾ ਫਿਸ਼ ਸਭ ਕੁਝ ਮਿਲਜੂ ਜੀ ਹਾਂਜੀ ਸਾਨੂੰ ਮੁਰਗੇ ਦਾ ਚਾਹੀਦਾ ਜੀ ਫਿਸ਼ ਫਿਸ਼ ਹਾਂਜੀ ਐਡਰੈਸ ਜੀ ਹੰਡਿਆਇਆ ਰੋਡ ਜੀ ਅਤੇ ਸਿੰਮੀ ਪੇਲਸ ਉੱਥੇ ਆ ਜੀ ਮੋਬਾਈਲ ਨੰਬਰ ਜੀ ਪਚਾਸੀ ਚਾਰ ਸੌ ਉਣੰਜਾ ਤਰਤਾਲੀ ਤਿੰਨ ਸੌ ਦੋ ਹਾਂਜੀ ਡੇਟ ਜੀ ਤੀਹ ਸਤੰਬਰ ਦੋ ਹਜ਼ਾਰ ਚੌਵੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਕੇ